ਜੀ ਹਾਂ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਬੱਚਤ ਖਾਤਾ ਬਣਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਬੱਚਿਆ ਨੂੰ ਬੱਚਤਾਂ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ ਅੱਜ ਦੀ ਬੱਚਤ ਕੱਲ੍ਹ ਦਾ ਫਾਇਦਾ ਹੁੰਦਾ ਹੈ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਕੀਤੀ ਹੋਈ ਬੱਚਤ ਨਾਲ ਕੱਲ੍ਹ ਨੂੰ ਸਾਨੂੰ ਕੱਲ੍ਹ ਨੂੰ ਕਿੱਡਾ ਵੱਡਾ ਫਾਇਦਾ ਹੋ ਸਕਦਾ ਹੈ ਅੱਜ ਦੀ ਕੀਤੀ ਬੱਚਤ ਸਾਡੇ ਭਵਿੱਖ ਭਵਿੱਖ ਵਿੱਚ ਬਹੁਤ ਕੰਮ ਆਵੇਗੀ ਬੱਚਿਆਂ ਨੂੰ ਇਸ ਨਾਲ ਉਤਸ਼ਾਹਿਤ ਕਰਨ ਲਈ ਨਿੱਕੀਆਂ ਨਿੱਕੀਆਂ ਬੱਚਤਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਉਹਨਾਂ ਦੇ ਜੇਬ ਖਰਚੇ ਦਾ ਕੁਝ ਭਾਗ ਬੱਚਤ ਲਈ ਰੱਖਣਾ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਸ ਨਾਲ ਬੱਚਿਆਂ ਦੇ ਭਵਿੱਖ ਵਿੱਚ ਉਹ ਬੱਚਤ ਕੰਮ ਆ ਸਕੇ ਇਸ ਲਈ ਬੱਚਿਆਂ ਨੂੰ ਸੋ ਬੱਚਤਾਂ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ ਬੱਚਤਾਂ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਸ ਨਾਲ ਅੱਜ ਦੀ ਕੀਤੀ ਬੱਚਤ ਥੋੜ੍ਹੀ ਥੋੜ੍ਹੀ ਕਰਕੇ ਕੱਲ੍ਹ ਨੂੰ ਸਾਨੂੰ ਵੱਡਾ ਫਾਇਦਾ ਕਰ ਦਿੰਦੀ ਹੈ ਜਿਸ ਤਰ੍ਹਾਂ ਪੰਜਾਬੀ ਦੀ ਕਹਾਵਤ ਹੈ ਬੂੰਦ ਬੂੰਦ ਨਾਲ ਗਿਲਾਸ ਭਰ ਜਾਂਦਾ ਹੈ ਉਸੇ ਤਰ੍ਹਾਂ ਛੋਟੀਆਂ ਛੋਟੀਆਂ ਬੱਚਤਾਂ ਨਾਲ ਆਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਸਾਰਾ ਲਾਭ ਹੁੰਦਾ ਹੈ ਕਈ ਵਾਰ ਇਹ ਬੱਚਤਾਂ ਸਾਨੂੰ ਬਹੁਤ ਵੱਡਾ ਲਾਭ ਪਹੁੰਚਾਉਂਦੀਆਂ ਹਨ ਇਸ ਲਈ ਬੱਚਿਆਂ ਨੂੰ ਬੱਚਤਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਹਨਾਂ ਬੱਚਤਾਂ ਦੇ ਫਾਇਦੇ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਬੱਚਤਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ